ਰੋਜ਼ੀ ਰੋਟੀ ਜੋ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਿਜਲੀ 'ਤੇ ਨਿਰਭਰ ਹੋ ਗਈ ਹੈ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਨਵੀਆਂ ਨਵੀਆਂ ਕਾਢਾਂ ਇਲੈਕਟ੍ਰੋਨਿਕ ਸਮਾਨ ਜਿਵੇਂ ਕਿ ਇੰਡਕਸ਼ਨ ਹੋ ਗਏ ਓਵਨ ਵਗੈਰਾ ਇਹਨਾਂ ਦੀਆਂ ਕਾਢਾਂ ਹੋਗੀਆਂ ਹਨ ਜਿਸ ਕਰਕੇ ਆਪਾਂ ਆਪਣਾ ਕੰਮ ਤਾਂ ਆਸਾਨ ਕਰਦੇ ਹਾਂ ਪਰ ਇਹਦੇ ਨਾਲ਼ ਸਾਨੂੰ ਬਹੁਤ ਹੀ ਸਹੂਲਤਾਂ ਮਿਲੀਆਂ ਹੋਈਆਂ ਹਨ ਅਤੇ ਇਹਨਾਂ 'ਤੇ ਜਦੋਂ ਬਿਜਲੀ ਦੇ ਕੱਟ ਵਗੈਰਾ ਲੱਗ ਲੱਗਦੇ ਆ ਪਿੰਡਾਂ ਵਿੱਚ ਜ਼ਿਆਦਾਤਰ ਪਪੂਲਰ ਵਗੈਰਾ ਜਾਂ ਰੁੱਖ ਵਗੈਰਾ ਹੁੰਦੇ ਆ ਉਹਨਾਂ ਕਰਕੇ ਪਿੰ ਬਿਜਲੀ ਦੀਆਂ ਜਿਹੜੀਆਂ ਤਾਰਾਂ ਏਂ ਉਹ ਕੱਟ ਹੋ ਜਾਂਦੀਆਂ ਏ ਜਿਹਦੇ ਕਰਕੇ ਪਿੰਡਾਂ ਵਿੱਚ ਬਿਜਲੀ ਦੀ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਇੱਕ ਜਾਂ ਦੋ ਦਿਨ ਨਹੀਂ ਪਿੰਡਾਂ ਵਿੱਚ ਤਿੰਨ ਜਾਂ ਚਾਰ ਦਿਨ ਤਾਂ ਕੱਟ ਲੱਗ ਹੀ ਜਾਂਦਾ ਹੈ ਜਿਹਦੇ ਕਰਕੇ ਪਿੰਡਾਂ ਦੇ ਲੋਕਾਂ ਕੋਲ ਇਨਵਰਟਰ ਵਗੈਰਾ ਦੀਆਂ ਸਹੂਲਤਾਂ ਤਾਂ ਹਨ ਪਰ ਉਹ ਵੀ ਹੁਣ ਇੱਕ ਜਾਂ ਦੋ ਦਿਨ ਚੱਲਦੇ ਆ ਪਰ ਫਿਰ ਜ਼ਿਆਦਾ ਦਿਨ ਉਹ ਵੀ ਨਹੀਂ ਚੱਲਦੇ ਅਤੇ ਜਿਹਦੇ ਕਰਕੇ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਪ ਇਲੈਕਟ੍ਰੋਨਿਕਸ ਸਮਾਨ ਹੈ ਜਾਂ ਉਹਨਾਂ ਦੀ ਉਹਨਾਂ ਨੂੰ ਆਦਤ ਪਈ ਹੋਈ ਯੂਜ਼ ਕਰਨ ਦੀ ਉਹਨਾਂ ਦੀਆਂ ਉਹਨਾਂ ਦੇ ਯੂਜ਼ ਕਰਨ ਵਿੱਚ ਜਾਂ ਫਿਰ ਜਿਹੜੇ ਉਹਨਾਂ ਦੇ ਯੂਜ਼ ਟੂ ਹੋ ਗਏ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਆਪਾਂ ਗੱਲ ਕਰੀਏ ਕਿ ਹੋਰ ਸਾਡੇ ਕੋਲ ਕਿਹੜੇ ਸਾਧਨ ਹੋ ਸਕਦੇ ਆ ਕਿ ਬਿਜਲੀ ਨਾ ਹੋਵੇ ਅਤੇ ਸਾਡੀ ਰੋਟੀ ਵਗੈਰਾ ਦਾ ਕਿਵੇਂ ਜਿਵੇਂ ਲੈਂਪ ਵਗੈਰਾ ਹੋ ਗਏ ਅਤੇ ਹੋਰ ਜਿਵੇਂ ਅੱਜ ਕੱਲ੍ਹ ਸੋਲਰ ਸਿਸਟਮ ਦਾ ਬਹੁਤ ਜ਼ਿਆਦਾ ਸੋਲਰ ਸਿਸਟਮ ਲੋਕ ਜ਼ਿਆਦਾ ਲਵਾ ਰਹੇ ਆ ਉਹ ਵੀ ਵਧੀਆ ਏ ਕੀ ਹਾਂ ਜਿਵੇਂ ਬਿਜਲੀ ਦੇ ਲਿਆਉਣ ਵਿੱਚ ਉਹ ਵੀ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਇਸ ਕਰਕੇ ਸਾਨੂੰ ਇਨਵਰਟਰ ਦੇ ਨਾਲ਼ ਸੋਲਰ ਸਿਸਟਮ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ